ਟੈਕਨੋਲੋਜੀ ਨੇ ਬੈਂਕਿੰਗ ਨੂੰ ਬਹੁਤ ਆਸਾਨ ਬਣਾਇਆ ਹੈ ਇਸ ਨਾਲ ਬਹੁਤ ਫਾਇਦੇ ਹੋਏ ਹਨ ਜਿਵੇਂ ਕਿ ਪਹਿਲਾ ਲੋਕ ਆਪਣੇ ਘਰ ਹੀ ਸਭ ਕੁਝ ਰੱਖਦੇ ਸੀਗੇ ਪੈਸਾ ਵਗੈਰਾ ਜਿਸ ਨਾਲ ਬਹੁਤ ਚੋਰੀਆਂ ਹੁੰਦੀਆਂ ਸੀ ਅੱਜ ਕੱਲ੍ਹ ਦੇ ਸਮੇਂ 'ਚ ਲੋਕ ਸਾਰੇ ਟੈਕਨੋਲੋਜੀ ਕਰਕੇ ਬੈਂਕਾਂ 'ਚ ਪੈਸਾ ਰੱਖਦੇ ਹਨ ਜਿਸ ਨਾਲ ਫਰੋਡ ਵੀ ਘੱਟ ਹੁੰਦੇ ਨੇ ਅਤੇ ਚੋਰੀਆਂ ਵੀ ਔਰ ਇਸ ਨਾਲ ਮੋਰ ਇੰਟਰਸਟ ਵੀ ਪੈਂਦਾ ਹੈ ਔਰ ਸੇਫ ਵੀ ਬਹੁਤ ਹੈ ਸਾਡੇ ਪੈਸੇ ਬੈਂਕਾਂ ਦੇ ਵਿੱਚ ਟੈਕਨੋਲੋਜੀ ਕਰਕੇ ਈਜੀ ਟਰਾਂਸਲੇਸ਼ਨ ਹੋ ਜਾਂਦੀਆਂ ਨੇ ਔਨਲਾਈਨ ਪੇਮੈਂਟ ਕਰ ਸਕਦੇ ਹਾਂ ਆਪਾਂ ਕਿਸੇ ਨੂੰ ਵੀ ਭਾਵੇਂ ਉਹ ਪੰਜ ਰੁਪਏ ਕਿਉਂ ਨਾ ਹੋਣ ਆਪਾਂ ਇਜਿਲੀ ਕਰ ਸਕਦੇ ਪਹਿਲਾ ਕੀ ਸੀ ਪਹਿਲਾਂ ਬੈਂਕ ਤੋਂ ਕਢਾਓ ਫਿਰ ਕਰੋ ਹੁਣ ਕੀ ਹੋ ਗਿਆ ਟੈਕਨੋਲੋਜੀ ਵਧਦੀ ਜਾ ਰਹੀ ਜਿਸ ਕਰਕੇ ਸਾਡੀ ਗਰੋਥ ਵੀ ਵੱਧ ਰਹੀ ਹੈ